ਪੰਜ ਅਗਸਤ ਉੱਨੀ ਸੌ ਨੜੀਨਵੇਂ ਸਤਾਈ ਜੁਲਾਈ ਦੋ ਹਜ਼ਾਰ ਦੋ ਸਤਾਰਾਂ ਅਕਤੂਬਰ ਦੋ ਹਜ਼ਾਰ ਪੰਜ ਪੰਦਰਾਂ ਅਗਸਤ ਉੱਨੀ ਸੌ ਸੰਨਤਾਲੀ ਚੌਦਾਂ ਦਿਸੰਬਰ ਦੋ ਹਜ਼ਾਰ ਚੌਦਾਂ